ਹਾਂ ਮੈਂ ਇੱਕ ਦਿਨ ਇੱਕ ਚਿੱਤਰਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਘਰ ਪਏ ਕੁਝ ਰੰਗ ਲਏ ਅਤੇ ਇੱਕ ਪੇਪਰ 'ਤੇ ਕੁਝ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਕੁਝ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੀ ਸੀ ਜੋ ਦੇਖਣ ਵਿੱਚ ਵੀ ਸੋਹਣਾ ਲੱਗੇ ਅਤੇ ਸਾਡੇ ਸੱਭਿਆਚਾਰ ਨਾਲ ਵੀ ਜੁੜਿਆ ਹੋਵੇ ਫਿਰ ਮੈਂ ਸੋਚਿਆ ਕਿ ਮੈਂ ਖੂਹ 'ਤੇ ਭਰਦੀਆਂ ਮੁਟਿਆਰਾਂ ਦੀ ਤਸਵੀਰ ਬਣਾਉਂਦੀ ਹਾਂ ਪਹਿਲਾਂ ਮੈਨੂੰ ਲੱਗ ਰਿਹਾ ਸੀ ਵੀ ਮੈਂ ਇਹ ਚਿੱਤਰਕਾਰ ਨਹੀਂ ਕਰ ਸਕਦੀ ਫਿਰ ਮੈਂ ਫਿਰ ਮੈਂ ਉਸ ਵਿੱਚ ਕਲਰ ਭਰਨੇ ਸਟਾਰਟ ਕੀਤੇ ਉਹ ਪੇਂਟਿੰਗ ਬਹੁਤ ਸੋਹਣੀ ਲੱਗ ਰਹੀ ਸੀ ਤਾਂ ਮੈਨੂੰ ਉਸ ਸਮੇਂ ਅਨੁਭਵ ਹੋਇਆ ਕਿ ਜੋ ਕੰਮ ਮਨ ਲਾ ਕੇ ਕੀਤਾ ਹੋ ਜਾਵੇ ਉਹ ਕੰਮ ਸਫਲ ਹੁੰਦਾ ਹੈ ਅਤੇ ਉਹ ਚਿੱਤਰਕਾਰੀ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ ਹੋਈ ਅਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਖੁਸ਼ ਮੇਰੇ ਘਰਦਿਆਂ ਨੂੰ ਵੀ ਬਹੁਤ ਚੰਗੀ ਲੱਗੀ ਸੀ ਅਤੇ ਫਿਰ ਜਦੋਂ ਮੈਂ ਉਹ ਚਿੱਤਰਕਾਰੀ ਸਕੂਲ ਵਿੱਚ ਜਾ ਕੇ ਆਪਣੇ ਅਧਿਆਪਕਾਂ ਨੂੰ ਦਿਖਾਈ ਤਾਂ ਉਹਨਾਂ ਨੇ ਵੀ ਉਹ ਪੇਂਟਿੰਗ ਬਹੁਤ ਸੋਹਣੀ ਲੱਗੀ ਅਤੇ ਉਹਨਾਂ ਨੇ ਉਹ ਪੇਂਟਿੰਗ ਅਪ ਸਾਡੀ ਕਲਾਸ ਦੇ ਵਿੱਚ ਲਗਾ ਦਿੱਤੀ ਧੰਨਵਾਦ